ਸਤਿ ਸ਼੍ਰੀ ਅਕਾਲ ਜੀ ਸਾਡੇ ਘਰ ਜਦੋਂ ਪ੍ਰਾਹੁਣੇ ਆਉਂਦੇ ਨੇ ਮੈਨੂੰ ਤਾਂ ਉਹਨਾਂ ਨੂੰ ਦੇਖ ਕੇ ਚਾਅ ਹੀ ਚੜ੍ਹ ਜਾਂਦਾ ਮੈਂ ਤਾਂ ਪ੍ਰਾਹੁਣਿਆਂ ਦਾ ਬਹੁਤ ਸਤਿਕਾਰ ਕਰਦੀ ਹਾਂ ਪ੍ਰਾਹੁਣਿਆਂ ਨੂੰ ਆਣ ਕੇ ਮੈਂ ਆਪਣੇ ਕਮਰੇ 'ਚ ਬਿਠਾ ਕੇ ਉਹਨਾਂ ਨੂੰ ਪਾਣੀ ਪਿਆਉਂਦੀ ਹਾਂ ਜੇ ਤਾਂ ਗਰਮੀ ਹੋਵੇ ਮੈਂ ਤਾਂ ਉਹਨਾਂ ਨੂੰ ਨਿੰਬੂ ਪਾਣੀ ਪਿਆਉਂਦੀ ਹਾਂ ਫਿਰ ਮੈਂ ਉਹਨਾਂ ਲਈ ਗੱਲਾਂ ਬਾਤਾਂ ਕਰਕੇ ਉਨ੍ਹਾਂ ਦੇ ਨਾਲ਼ ਉਹਨਾਂ ਲਈ ਚਾਹ ਬਣਾਉਂਦੀ ਹਾਂ ਚਾਹ ਦੇ ਵਿੱਚ ਮੈਂ ਉਹਨਾਂ ਲਈ ਪਕੌੜੇ ਬਿਸਕੁਟ ਅਤੇ ਸਮੋਸੇ ਦਿੰਦੀ ਹਾਂ ਫਿਰ ਅਸੀਂ ਬੈਠ ਕੇ ਗੱਲਾਂ ਬਾਤਾਂ ਮਾਰਦੇ ਹਾਂ ਅਤੇ ਹਸੀ ਮਜ਼ਾਕ ਕਰਦੇ ਹਾਂ ਜਿਵੇਂ ਲੋਕ ਕਈ ਕਿਸਮ ਦੀਆਂ ਚੀਜ਼ਾਂ ਮੇਰੇ ਹੱਥ ਦੀਆਂ ਖਾ ਸਾਡੇ ਪ੍ਰਾਹੁਣੇ ਮੇਰੇ ਹੱਥ ਦੀਆਂ ਚੀਜ਼ਾਂ ਖਾਣੀਆਂ ਪਸੰਦ ਕਰਦੇ ਨੇ ਮੈਨੂੰ ਲੋਕਾਂ ਲਈ ਚੀਜ਼ਾਂ ਬਣਾਉਣੀਆਂ ਬਹੁਤ ਵਧੀਆ ਲੱਗਦੀਆਂ ਪ੍ਰਾਹੁਣਿਆਂ ਲਈ ਉਹ ਮੇਰੇ ਹੱਥ ਦੀ ਦਾਲ ਮੱਖਣੀ ਖਾਣੀ ਬਹੁਤ ਪਸੰਦ ਕਰਦੇ ਨੇ ਅਤੇ ਮੈਨੂੰ ਵੀ ਬਣਾਉਣ ਦਾ ਬਹੁਤ ਚਾਅ ਜਿਹਾ ਚੜ੍ਹ ਜਾਂਦਾ ਏ ਦਾਲ ਮੱਖਣੀ ਬਣਾਉਣ ਦਾ ਮੈਂ ਉਹਨਾਂ ਲਈ ਮਟਰਾਂ ਵਾਲੇ ਚੌਲ ਵੀ ਬਣਾਉਂਦੀ ਹਾਂ ਮਟਰਾਂ ਵਾਲੇ ਚੌਲ ਬਣਾਉਣ ਦਾ ਮੇਰਾ ਤਾਂ ਇੱਕ ਅਲੱਗ ਹੀ ਤਰੀਕਾ ਹੈ ਮੈਂ ਉਹਨਾਂ ਨੂੰ ਵੋਸ਼ ਕਰਕੇ ਅਤੇ ਉਹਨਾਂ ਵਿੱਚ ਜੀਰਾ ਪਾ ਕੇ ਗਾਜਰਾਂ ਪਾ ਕੇ ਗੋਭੀ ਪਾ ਕੇ ਬਿਲਕੁਲ ਅਲੱਗ ਤਰੀਕੇ ਨਾਲ਼ ਬਣਾਉਂਦੀ ਹਾਂ ਅਤੇ ਮੈਂ ਆਪਣੇ ਪ੍ਰਾਹੁਣਿਆਂ ਲਈ ਆਮ ਫੁਲਕੇ ਤਾਂ ਸਾਰੇ ਹੀ ਬਣਾ ਲੈਂਦੇ ਨੇ ਪਰ ਮੈਂ ਆਪਣੇ ਪ੍ਰਾਹੁਣਿਆਂ ਲਈ ਤੰਦੂਰੀ ਫੁਲਕੇ ਕੁੱਕਰ ਵਿੱਚ ਬਣਾ ਕੇ ਖਵਾਉਂਦੀ ਹਾਂ ਮੈਨੂੰ ਉਹ ਬਣਾਉਣਾ ਬੜੇ ਵਧੀਆ ਲੱਗਦੇ ਨੇ ਅਤੇ ਸਾਡੇ ਜਿਹੜੇ ਪ੍ਰਾਹੁਣੇ ਨੇ ਉਹ ਮੇਰੇ ਹੱਥ ਦੇ ਤੰਦੂਰੀ ਫੁਲਕੇ ਖਾ ਕੇ ਵੀ ਬਹੁਤ ਪਸੰਦ ਕਰਦੇ ਨੇ ਖਾਣਾ ਇਸ ਲਈ ਮੈਂ ਉਹਨਾਂ ਨੂੰ ਅਲੱਗ ਤਰੀਕੇ ਨਾਲ਼ ਬਣਾਉਂਦੀ ਹਾਂ ਅਤੇ ਉਹਨਾਂ ਨੂੰ ਮੈਂ ਜਦੋਂ ਤੰਦੂਰੀ ਫੁਲਕੇ ਬਣਾਉਂਦੀ ਹਾਂ ਅਤੇ ਮੈਂ ਉਸ ਕੁੱਕਰ ਵਿੱਚ ਹੀ ਬਣਾਉਂਦੀ ਹਾਂ ਅਤੇ ਉਹਨੂੰ ਅਲੱਗ ਆਟਾ ਗੁੰਨ ਕੇ ਉਹਦੇ ਥੋੜ੍ਹਾ ਜਿਹਾ ਘਿਓ ਪਾ ਕੇ ਆਟੇ ਨੂੰ ਨਰਮ ਕਰਕੇ ਫਿਰ ਉਹਨੂੰ ਵੇਲ ਕੇ ਉਹਦੇ ਵਿੱਚ ਘਿਓ ਲਾ ਕੇ ਫਿਰ ਉਹਨੂੰ ਕੁੱਕਰ ਦੇ ਵਿੱਚ ਲਾਉਂਦੀ ਹਾਂ ਅਤੇ ਮੈਂ ਕੁੱਕਰ ਦੇ ਵਿੱਚ ਲੱਛੇ ਵਾਲੇ ਪਰੌਂਠੇ ਵੀ ਬਣਾ ਲੈਂਦੀ ਹਾਂ ਧੰਨਵਾਦ